ਜਦੋਂ ਅਸੀਂ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਵਿਗਿਆਨ ਅਤੇ ਤਕਨੀਕੀ ਖੇਤਰਾਂ ਦੀ ਸਿਫਾਰਿਸ਼ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਆਈ ਆਈ ਟੀ ਦੀ ਹੀ ਸਿਫਾਰਿਸ਼ ਕਰਦੇ ਹਾਂ ਕਿਉਂਕਿ ਉੱਥੇ ਸਿੱਖਿਆ ਅਤੇ ਤਕਨੀਕੀ ਖੇਤਰ ਬਹੁਤ ਵਧੀਆ ਹੈ ਸਿੱਖਿਆ ਵੀ ਬਹੁਤ ਵਧੀਆ ਉੱਥੇ ਅਤੇ ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹਾ ਰੋਪੜ ਦੇ ਵਿੱਚ ਪੈ ਜਾਂਦੀ ਹੈ